ਸਤਿ ਸ਼੍ਰੀ ਅਕਾਲ ਜੀ ਤੁਸੀਂ ਸਵੀਗੀ ਤੋਂ ਬੋਲਦੇ ਹੋ ਮੇਰਾ ਨਾਮ ਦਲਬੀਰ ਹੈ ਜੀ ਅਸੀਂ ਤੁਹਾਡੇ ਤੋਂ ਰੋਜ਼ ਖਾਣਾ ਔਡਰ ਕਰਦੇ ਹਾਂ ਤੁਸੀਂ ਬਹੁਤ ਖਾਣਾ ਬਹੁਤ ਸਵਾਦ ਜ ਬਣਾਉਂਦੇ ਹੋ ਅੱਜ ਮੈਂ ਤੁਹਾਡੇ ਤੋਂ ਕੋਈ ਨਵੀਂ ਚੀਜ਼ ਔਡਰ ਕਰਨਾ ਚਾਹੁੰਦਾ ਹਾਂ ਕੀ ਤੁਹਾਡੇ ਕੋਲ ਕੋਈ ਨਈ ਨਿਆਂ ਵਿਅੰਜਨ ਹੈਗਾ ਜੀ ਵੈਸੇ ਮੈਂ ਕਦੇ ਇਹ ਵਿਅੰਜਨ ਖਾਦਾ ਤਾਂ ਨਹੀਂ ਹੈਗਾ ਜੀ ਪਰ ਅਸੀਂ ਅੱਜ ਇਹ ਚੀਜ਼ ਔਡਰ ਕਰਨਾ ਚਾਹੁੰਦੇ ਹਾਂ ਕਿਰਪਾ ਕਰਕੇ ਮੈਨੂੰ ਦੱਸਿਆ ਜਾਵੇ ਕਿ ਇਹ ਚੀਜ਼ ਸਾਡੇ ਕੋਲ ਕਿੰਨੇ ਵਜੇ ਤੱਕ ਪਹੁੰਚ ਜਾਵੇਗੀ ਠੀਕ ਹੈ ਜੀ ਧੰਨਵਾਦ